ਆਵਾਜਾਈ ਦੇ ਸਾਧਨਾਂ ਦੇ ਵਿਕਸਿਤ ਹੋਣ ਦੇ ਨਾਲ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਸੁਧਾਰ ਆਇਆ ਹੈ ਕੋਈ ਸਮਾਂ ਸੀ ਜਦੋਂ ਦੂਰ ਦੁਰਾਡੇ ਜਾਣ ਵਾਸਤੇ ਬਹੁਤ ਘੱਟ ਸਾਧਨ ਹੁੰਦੇ ਸਨ ਪਰ ਅੱਜ ਆਵਾਜਾਈ ਦੇ ਸਾਧਨ ਇੰਨੀ ਤੇਜ਼ੀ ਨਾਲ ਪ੍ਰਫੁਲਤ ਹੋ ਰਹੇ ਹਨ ਕਿ ਮਨੁੱਖ ਮਿੰਟਾਂ ਸਕਿੰਟਾਂ ਦੇ ਵਿੱਚ ਹਜ਼ਾਰਾਂ ਹੀ ਕਿਲੋਮੀਟਰ ਦਾ ਸਫਰ ਤੈਅ ਕਰ ਦਿੰਦਾ ਹੈ ਉਦਾਹਰਨ ਵਜੋਂ ਹਵਾਈ ਜਹਾਜ਼ ਹਵਾਈ ਜਹਾਜ਼ ਦੇ ਕਾਰਨ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸਫ਼ਰ ਨੂੰ ਨਿਪਟਾ ਸਕਦੇ ਹਾਂ